ਹੈਲੋ ਸਤਿ ਸ਼੍ਰੀ ਅਕਾਲ ਬੇਟਾ ਕੌਣ ਬੋਲਦੇ ਉਹ ਬੱਚੇ ਠੀਕ ਠੀਕ ਹੈ ਵੈਰੀ ਗੁਡ ਹੋਰ ਠੀਕ ਹੋ ਤੁਸੀਂ ਬਹੁਤ ਬਹੁਤ ਮੁਬਾਰਕਾਂ ਬੇਟਾ ਤੁਹਾਨੂੰ ਅਤੇ ਤੁਹਾਡੇ ਟੀਚਰਾਂ ਨੂੰ ਜਿਹਨਾਂ ਨੇ ਤੁਹਾਨੂੰ ਪੜ੍ਹਾਇਆ ਬਹੁਤ ਬਹੁਤ ਮੁਬਾਰਕਾਂ ਹੋਰ ਸਭ ਠੀਕ ਹੈ ਘਰ ਕੀ ਕਰ ਰਹੇ ਹੋ ਅੱਜ ਕੱਲ੍ਹ ਬਿਲਕੁਲ ਬੇਟਾ ਮੈਂ ਪੁੱਛਣਾ ਹੀ ਸੀ ਤੁਹਾਨੂੰ ਚਲੋ ਬਹੁਤ ਅੱਛਾ ਹੋ ਗਿਆ ਤੁਹਾਡਾ ਫੋਨ ਆ ਗਿਆ ਕੀ ਸੋਚਿਆ ਅੱਗੇ ਤੁਸੀਂ ਆਪਣੇ ਭਵਿੱਖ ਬਾਰੇ ਆਪਣੇ ਉਦੇਸ਼ ਕੀ ਆ ਤੁਹਾਡਾ ਗੋਲ ਕੀ ਹੈ ਕੀ ਸੋਚਿਆ ਅੱਗੇ ਅਂ ਬੇਟਾ ਸਭ ਤੋਂ ਪਹਿਲਾਂ ਤਾਂ ਤੁਸੀਂ ਜਿੰਨਾ ਚਿਰ ਘਰ ਹੋ ਆਪਣਾ ਸਮਾਂ ਬਰਬਾਦ ਨਾ ਕਰੋ ਯੂਟੀਊਬ 'ਤੇ ਜਾ ਕੇ ਇੱਕ ਟੀਚਰ ਨੇ ਬਹੁਤ ਅੱਛੇ ਡਾਕਟਰ ਜਸਵਿੰਦਰ ਸਿੰਘ ਮੈਥ ਦੇ ਬਹੁਤ ਅੱਛੇ ਅਂ ਪ੍ਰੈਕਟੀਕਲ ਟੀਚਰ ਨੇ ਜਿਹੜਾ ਬੱਚਾ ਜਮ੍ਹਾਂ ਡੱਲ ਹੁੰਦਾ ਉਹਨੂੰ ਵੀ ਮੈਥ ਸਿਖਾ ਦਿੰਦੇ ਉਸ ਤੋਂ ਅਗਲੀ ਗੱਲ ਬੇਟਾ ਤੁਸੀਂ ਕਿਤੇ ਕੋਚਿੰਗ ਲਓ ਜਿਸ ਤਰ੍ਹਾਂ ਇੱਕ ਬਠਿੰਡਾ ਵਿੱਚ ਅਕੈਡਮੀ ਹੈ ਬੰਸਲ ਅਕੈਡਮੀ ਉਹ ਵੀ ਅੱਛੀ ਕੋਚਿੰਗ ਦਿੰਦੇ ਨੇ ਅੱਗੇ ਤੁਸੀਂ ਬੀਐੱਸਸੀ ਮੈਥਮੈਟਿਕਸ ਦੇ ਵਿੱਚ ਜਾ ਸਕਦੇ ਹੋ ਫਿਰ ਅੱਗੇ ਐਮਏ ਔਰ ਪੀਐਚਡੀ ਤੱਕ ਬੇਟਾ ਜੇ ਤੁਸੀਂ ਅੱਗੇ ਤੁਹਾਡਾ ਮਿਸ਼ਨ ਹੀ ਇਹ ਹੈ ਥੋੜ੍ਹੀ ਮਨ ਨਾਲ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਟੀਚਰ ਬਣਨਾ ਚਾਹੁੰਦੇ ਹੋ ਚੰਗੇ ਮੈਥ ਦੇ ਗਣਿਤ ਦੇ ਤਾਂ ਪੁੱਤਰ ਇਸ ਤੋਂ ਵਧੀਆ ਲੈਨ ਕੋਈ ਨਹੀਂ ਹੋ ਸਕਦੀ ਪਰ ਇਹਦੇ ਵਿੱਚ ਤੁਸੀਂ ਪੂਰੇ ਲਗਨ ਦੇ ਨਾਲ ਪੜ੍ਹੋ ਕਿਉਂਕਿ ਕਈ ਬੱਚੇ ਵਿੱਚੋਂ ਛੱਡ ਜਾਂਦੇ ਨੇ ਮੇਰੇ ਅ ਪੜੋਸ ਦੇ ਵਿੱਚ ਇੱਕ ਲੜਕਾ ਪੁਲਿਸ ਵਾਲੇ ਦਾ ਉਹ ਇੱਦਾਂ ਹੀ ਵਿੱਚੋਂ ਛੱਡ ਗਿਆ ਤਾਂ ਬੇਟਾ ਗੋਲ ਉਹ ਲਓ ਸੋਚ ਸਮਝ ਕੇ ਵਿਚਾਰ ਕਰਕੇ ਆਪਣੇ ਮਨ ਦੀ ਸੁਣ ਕੇ ਕਿਸੇ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਨਾ ਕਰਿਓ ਕਿਉਂਕਿ ਤੁਹਾਡਾ ਕਰੀਅਰ ਤੁਹਾਡਾ ਭਵਿੱਖ ਤੁਹਾਡਾ ਗੋਲ ਤੁਹਾਡਾ ਉਦੇਸ਼ ਠੀਕ ਹੈ ਤੁਹਾਡੇ 'ਤੇ ਹੀ ਡਿਪੈਂਡ ਹੈ ਕਿਉਂਕਿ ਮਾਂ ਪਿਓ ਨੇ ਤੁਹਾਨੂੰ ਪਲੱਸ ਟੂ ਤੱਕ ਪੜ੍ਹਾਇਆ ਤੁਸੀਂ ਬਹੁਤ ਅੱਛੇ ਇਸ ਸਕੂਲ ਦੇ ਸਟੂਡੈਂਟ ਰਹੇ ਤੁਹਾਨੂੰ ਦੇਖ ਕੇ ਧਿਆਨ ਆ ਰਿਹਾ ਤੁਹਾਡੀ ਗੱਲ ਸੁਣ ਕੇ ਅਤੇ ਤੁਸੀਂ ਸਕੂਲ ਦੇ ਵਿੱਚ ਵੀ ਬਹੁਤ ਅੱਛੇ ਅ ਤੁਹਾਡਾ ਡਸਿਪਲਨ ਰਿਹਾ ਪੜ੍ਹਾਈ ਦੇ ਵਿੱਚ ਅੱਛੇ ਰਹੇ ਓਵਰਆਲ ਤੁਹਾਡਾ ਬੈਸਟ ਸੀ ਉਮੀਦ ਕਰਦਾਂ ਤੁਸੀਂ ਅੱਗੇ ਤੋਂ ਵੀ ਬੈਸਟ ਕਰੋਗੇ ਹੁਣ ਆਪਣੇ ਪੈਰੈਂਟਸ ਦਾ ਆਪਣੇ ਸਕੂਲ ਦਾ ਨਾਮ ਉੱਚਾ ਕਰੋਗੇ ਅਤੇ ਬੇਟਾ ਇੱਕ ਗੱਲ ਹੋਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਜੀ ਬੇਟਾ ਜੀ ਬੇਟਾ ਬੋਲੋ ਤੁਸੀਂ ਪਹਿਲਾਂ ਤੁਸੀਂ ਬੋਲੋ ਓਕੇ ਵੈਰੀ ਗੁੱਡ ਇਹ ਤਾਂ ਬਹੁਤ ਅੱਛਾ ਹੈ ਐਂ ਨਹੀਂ ਬੇਟਾ ਮੈਂ ਵੀ ਇਹ ਕਹਿਣਾ ਕਿਉਂਕਿ ਸਾਡੇ ਬੱਚੇ ਆਪਾਂ ਪਿੰਡ ਦੇ ਰਹਿਣ ਵਾਲੇ ਹਾਂ ਮੈਂ ਦੇਖਿਆ ਆਪਣੇ ਸਕੂਲ 'ਚ ਮੋਸਟਲੀ ਬੱਚਾ ਪਿੰਡ ਵਾਲਾ ਹੈ ਅਤੇ ਨਾਲੇ ਬੱਚੇ ਸਾਇੰਸ ਔਰ ਮੈਥ ਦੇ ਵਿੱਚ ਬਹੁਤ ਘੱਟ ਜਾਂਦੇ ਨੇ ਬੀਏ ਆਰਟਸ ਸਿੰਪਲ ਸਬਜੈਕਟ ਲੈਂਦੇ ਨੇ ਉਹ ਜੇ ਤੁਸੀਂ ਲੈ ਰਹੇ ਹੋ ਬੇਟਾ ਮਤਲਬ ਬਹੁਤ ਅੱਛੀ ਯੂਨੀਕ ਗੱਲ ਹੈ ਸਾਨੂੰ ਮਾਣ ਹੈ ਅਤੇ ਤੁਸੀਂ ਇਹ ਬੱਚਿਓ ਵੀ ਮੈਥ ਅ ਦੀ ਚੁਆਇਸ ਰੱਖੀ ਹੈ ਔਰ ਵਾਈਡ ਬਹੁਤ ਵੱਡਾ ਖੇਤਰ ਹੈ ਇਹਦੀ ਮੈਥ ਔਰ ਸਟੈਟਿਕ ਦੇ ਵਿੱਚ ਅਤੇ ਬੇਟਾ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਚਾਹੁੰਦਾ ਤੁਸੀਂ ਇਸ ਮੈਥ ਦੇ ਵਿੱਚ ਅ ਸਿਰਫ਼ ਕੈਲਕੂਲੇਸ਼ਨ ਦੇ ਵਿੱਚ ਨਾ ਰਹਿ ਜਾਇਓ ਤੁਸੀਂ ਨਾਲ ਕੁਝ ਸਾਹਿਤ ਦੇ ਨਾਲ ਜੁੜ ਕੇ ਰਹਿਓ ਲਿਟਰੇਚਰ ਦੇ ਨਾਲ ਕਿਉਂਕਿ ਮੈਂ ਇਹ ਚਾਹੁੰਦਾ ਕਿਉਂਕਿ ਬੱਚੇ ਦਾ ਉਦੇਸ਼ ਸਿਰਫ਼ ਪੁੱਤਰ ਇਹ ਨਹੀਂ ਹੁੰਦਾ ਵੀ ਉਹਨੇ ਵੱਡੀਆਂ ਵੱਡੀਆਂ ਡਿਗਰੀਆਂ ਲੈਣੀਆਂ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਮਾਨਵਤਾ ਔਰ ਇੱਕ ਅ ਮੋਰਲ ਵੈਲਿਊ ਸਿੱਖਣੀਆਂ ਹੁੰਦੀਆਂ ਉਹ ਜੋ ਤੁਹਾਨੂੰ ਅਂ ਸਿਰਫ਼ ਜਿਹੜੇ ਸਾਹਿਤ ਲਿਟਰੇਚਰ ਹੈ ਉਹ ਦੇ ਸਕਦਾ ਬੇਟਾ ਕਿਉਂਕਿ ਅੱਜ ਕੱਲ੍ਹ ਆਪਣੇ ਪਰਿਵਾਰ ਦੇ ਵਿੱਚ ਵੀ ਸਮਾਂ ਨਹੀਂ ਐਸਾ ਟਾਈਮ ਘੱਟ ਰਹਿ ਗਿਆ ਤਾਂ ਉਹਦੇ ਨਾਲ ਥੋੜ੍ਹਾ ਬਹੁਤਾ ਨਾਲ ਜੁੜ ਕੇ ਜ਼ਰੂਰ ਰਹਿਓ ਦੂਸਰੀ ਗੱਲ ਕਿਉਂਕਿ ਇਹ ਹੈ ਇੱਕਲਾ ਸਬਜੈਕਟ ਵੀ ਸਾਰਾ ਕੁਛ ਨਹੀਂ ਹੁੰਦਾ ਓਵਰਆਲ ਗਿਆਨ ਸਾਰਾ ਕੁਛ ਹੁੰਦਾ ਤਾਂ ਤੁਸੀਂ ਇੱਕ ਕੰਮ ਹੋਰ ਕਰਨਾ ਡੇਲੀ ਬੇਟਾ ਨਿਊਜ਼ ਪੇਪਰ ਪੜ੍ਹਨਾ ਨਿਊਜ਼ ਪੇਪਰ ਸਟੱਡੀ ਕਰਨਾ ਤੁਸੀਂ ਹਰ ਰੋਜ਼ ਪੜ੍ਹਨਾ ਠੀਕ ਹੈ ਉਹਦੇ ਨਾਲ ਸਬੰਧਿਤ ਜੋ ਵੀ ਅ ਤੁਹਾਨੂੰ ਲੱਗਦਾ ਤੁਹਾਡੇ ਸਬਜੈਕਟ ਨਾਲ ਸੰਬੰਧਿਤ ਕੋਈ ਗੱਲ ਹੈ ਕੋਈ ਵਾਕ ਹੈ ਉਹਨੂੰ ਨੋਟ ਕਰਨਾ ਕਾਪੀ 'ਤੇ ਠੀਕ ਹੈ ਮੇਰੀਆਂ ਮੇਰੀਆਂ ਤੁਹਾਨੂੰ ਬਹੁਤ ਬਹੁਤ ਸ਼ੁੱਭਕਾਮਨਾਵਾਂ ਤੁਸੀਂ ਜਿੱਥੇ ਵੀ ਰਹੋ ਖ਼ੁਸ਼ ਰਹੋ ਔਰ ਅੱਗੇ ਵਧੋ ਠੀਕ ਹੈ ਬੇਟਾ ਜਦੋਂ ਵੀ ਕਦੇ ਆਏ ਸਕੂਲ ਆ ਕੇ ਜਾਣਾ ਆਪਣੇ ਅਂ ਟੀਚਰਸ ਨੂੰ ਮਿਲ ਕੇ ਜਾਣਾ ਠੀਕ ਹੈ ਔਰ ਹੋਰ ਬੱਚਿਆਂ ਨੂੰ ਵੀ ਮੋਟੀਵੇਟ ਕਰਨਾ ਇਸ ਵਾਸਤੇ ਠੀਕ ਹੈ ਠੀਕ ਹੈ ਬੇਟਾ ਬਹੁਤ ਅੱਛਾ ਬਹੁਤ ਵੈਰੀ ਗੁਡ ਠੀਕ ਹੈ ਓਕੇ ਠੀਕ ਠੀਕ ਹੈ ਬੱਚੇ ਓਕੇ ਓਕੇ